ਨੈਣਾ ਦੇਵੀ ਦੀ ਚੜ੍ਹਾਈ ਤਿੰਨ ਚਾਰ ਕਿਲੋਮੀਟਰ ਹੈ ਮੇਰੇ ਤੋਂ ਅੱਗੇ ਦੋ ਲੇਡੀਜ਼ ਪੌੜੀਆਂ ਰਾਹੀਂ ਉੱਪਰ ਜਾ ਰਹੀਆਂ ਸਨ ਉਹਨਾਂ ਨੂੰ ਦੇਖ ਕੇ ਮੈਂ ਬੜਾ ਉਤਸ਼ਾਹਿਤ ਹੋਇਆ ਜਦੋਂ ਇਹ ਚੜ੍ਹ ਸਕਦੀਆਂ ਤਾਂ ਮੈਂ ਕਿਉਂ ਨਹੀਂ ਉਹਨਾਂ ਨੂੰ ਦੇਖ ਕੇ ਮੈਂ ਵੀ ਪੌੜੀਆਂ ਚੜ੍ਹਨੀਆਂ ਸਟਾਰਟ ਕਰ ਦਿੱਤੀਆਂ ਅਤੇ ਮੈਂ ਆਪਣੇ ਨਾਲ ਪਾਣੀ ਅਤੇ ਖਾਣ ਪੀਣ ਦਾ ਸਮਾਨ ਲੈ ਕੇ ਗਿਆ ਉੱਪਰ ਜਾ ਕੇ ਮੈਂ ਜਿਉਣਾ ਮੌੜ ਦੀ ਸਮਾਧ ਔਰ ਨੈਣਾ ਦੇਵੀ ਮੰਦਰ ਦੇਖਿਆ ਔਰ ਉੱਥੇ ਕਾਫ਼ੀ ਸ਼ਰਧਾਲੂ ਸਨ ਔਰ ਜਿਹੜੇ ਮਾਤਾ ਰਾਣੀ ਦੇ ਮੱਥਾ ਟੇਕਣ ਆਏ ਹੋਏ ਸਨ ਉਹਨਾਂ ਨੂੰ ਦੇਖ ਕੇ ਮੈਂ ਕਾਫੀ ਪ੍ਰਭਾਵਿਤ ਹੋਇਆ